ਮੇਰੀ ਸਭ ਤੋਂ ਪਹਿਲੀ ਟੀਚਰ ਮੇਰੀ ਮਾਂ ਹੈ ਜਿਹਨਾਂ ਤੋਂ ਮੈਂ ਸਭ ਤੋਂ ਪਹਿਲਾਂ ਸਿਲਾਈ ਕਢਾਈ ਸਿੱਖਿਆ ਮੈਨੂੰ ਬਚਪਨ ਤੋਂ ਹੀ ਬਹੁਤ ਸ਼ੌਂਕ ਸੀ ਸਿਲਾਈ ਕਢਾਈ ਬੁਣਾਈ ਦਾ ਅਤੇ ਮੇਰੇ ਮੰਮੀ ਨੇ ਮੈਨੂੰ ਸਾਰਾ ਕੁਛ ਸਿਖਾਇਆ ਅਤੇ ਹੁਣ ਮੈਂ ਸਾਰਾ ਕੁਛ ਯੂ ਯੂਟਿਊਬ ਤੋਂ ਦੇਖ ਕੇ ਸਿੱਖਦੀ ਹਾਂ ਯੂਟਿਊਬ 'ਤੇ ਮੈਂ ਕਈ ਚੈਨਲ ਸਬਸਕ੍ਰਾਈਬ ਕੀਤੇ ਹੋਏ ਨੇ ਜਿਹਨਾਂ ਤੋਂ ਦੇਖ ਕੇ ਮੈਂ ਨ ਰੋਜ਼ ਨਵੇਂ ਨਵੇਂ ਡਿਜ਼ਾਈਨ ਪਲਾਜ਼ੋ ਅਮਰੇਲਾ ਪਲਾਜ਼ੋ ਸੂਟ ਦੇ ਡਿਜ਼ਾਈਨ ਸਾਰਾ ਕੁਛ ਸਿੱਖਦੀ ਹਾਂ ਅਤੇ ਮੇਰੇ ਆਪਣੇ ਵੀ ਕਮਿਉਨਟੀ ਲਈ ਮੈਂ ਆਪਣੇ ਵੀ ਮੇਰੇ ਚੈਨਲ ਬਣਾਏ ਹੋਏ ਹਨ ਯੂਟਿਊਬ 'ਤੇ ਵੀ ਹੈ ਫੇਸਬੁੱਕ 'ਤੇ ਵੀ ਹੈ ਔਰ ਇੰਸਟਾਗ੍ਰਾਮ 'ਤੇ ਵੀ ਮੇਰੇ ਚੈਨਲ ਨੇ ਜਿਹਦੇ 'ਤੇ ਮੈਂ ਰੋਜ਼ ਆਪਣੇ ਸੂਟਾਂ ਦੀਆਂ ਵੀਡਿਓਜ਼ ਫੋਟੋਜ਼ ਵਗੈਰਾ ਅਪਲੋਡ ਕਰਦੀ ਹਾਂ ਅਤੇ ਮੇਰੇ ਨਾਲ਼ ਨਾਲ਼ ਕਮਿਊਨਟੀ ਨੂੰ ਵੀ ਸਿੱਖਣ ਨੂੰ ਕੁਛ ਮਿਲਦਾ ਹੈ ਅਤੇ ਲੋਕ ਮੇਰੇ ਸੂਟਾਂ ਨੂੰ ਮੇਰੇ ਡਿਜ਼ਾਈਨਾਂ ਨੂੰ ਬਹੁਤ ਪਸੰਦ ਕਰਦੇ ਨੇ ਅਤੇ ਬਹੁਤ ਪਿਆਰ ਦਿੰਦੇ ਨੇ